ਅੱਜ ਕੱਲ੍ਹ ਕੁੜੀਆਂ ਅਤੇ ਮੁੰਡੇ 'ਚ ਕੋਈ ਫਰਕ ਨਹੀਂ ਕੀਤਾ ਜਾਂਦਾ ਪਹਿਲਾਂ ਹੁੰਦਾ ਸੀ ਕਿ ਕੁੜੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ ਮੁੰਡਿਆਂ ਨੂੰ ਜ਼ਿਆਦਾ ਪੜ੍ਹਾਇਆ ਜਾਂਦਾ ਸੀ ਕੁੜੀਆਂ ਨੂੰ ਘਰ ਦੇ ਕੰਮ ਜ਼ਿਆਦਾ ਕਰਵਾਉਂਦੇ ਸੀ ਪਰ ਹੁਣ ਇਸ ਤਰ੍ਹਾਂ ਕੁਛ ਨਹੀਂ ਹੈਗਾ ਹੁਣ ਮੁੰਡੇ ਅਤੇ ਕੁੜੀਆਂ ਦੋਨਾਂ ਨੂੰ ਬਰਾਬਰ ਸਮਝਦੇ ਹਨ ਕੁੜੀਆਂ ਨੂੰ ਵੀ ਪੜ੍ਹਾਉਂਦੇ ਹਾਂ ਸਗੋਂ ਹੁਣ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਪੜ੍ਹਦੀਆਂ ਹਨ ਡਾਕਟਰ ਬਣਦੀਆਂ ਹਨ ਕੋਈ ਪੁਲਿਸ ਆਫਿਸਰ ਬਣਦੀਆਂ ਹਨ ਅਤੇ ਲੋਕਾਂ ਦੀਆਂ ਮਦਦ ਕਰਦੀਆਂ ਹਨ ਕਈ ਫਰੀ ਓ ਕੈ ਓ ਫਰੀ ਸੇਵਾਵਾਂ ਲਈ ਲਗਾਉਂਦੇ ਹਨ ਚੈੱਕਅਪ ਲਈ ਮਦਦ ਕਰਦੀਆਂ ਹਨ ਅੱਜ ਕੱਲ੍ਹ ਤਾਂ ਪੁਲਿਸ ਵਾਲੀਆਂ ਵੀ ਕੁੜੀਆਂ ਹਨ ਕਈ ਤਾਂ ਅਤੇ ਅੱਜ ਕੱਲ੍ਹ ਜਿਵੇਂ ਕਿ ਕੁੜੀਆਂ ਡਰਦੀਆਂ ਨਹੀਂ ਕਤਰਾਉਂਦੀਆਂ ਨਹੀਂ ਅਤੇ ਜੇ ਕਿਸੇ ਕੁੜੀ ਨੂੰ ਰਾਤ ਨੂੰ ਦਿੱਕਤ ਹੋਵੇ ਘਰ ਜਾਣ 'ਚ ਲੇਟ ਹੋ ਜਾਵੇ ਅਤੇ ਪੁ ਕੁੜੀਆਂ ਰੱਖੀਆਂ ਹੋਈਆਂ ਹਨ ਪੁਲਿਸ ਵਾਲੀਆਂ ਅਤੇ ਉਹ ਛੱਡ ਕੇ ਆਉਂਦੇ ਹਨ ਅਤੇ ਛੱਡ ਕੇ ਹੀ ਜਾਂਦੇ ਹਨ ਉਹਨਾਂ ਨੇ ਬੱਸ ਵੀ ਸ਼ੁਰੂ ਕੀਤੀ ਹੈ ਇਸ ਨਾਲ ਕੁੜੀਆਂ ਨੂੰ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਅਤੇ ਨਾਲੇ ਕੁੜੀਆਂ ਬਹੁਤ ਸੇਫ ਨੇ ਕੁੜੀਆਂ ਅੱਜ ਕੱਲ੍ਹ ਇੰਨੀਆਂ ਕੁ ਖੁਦ ਡਿਪੈਂਡ ਇੰਡੀਪੈਂਡੈਂਟ ਨੇ ਕਿ ਉਹਨਾਂ ਨੇ ਆਪਣੇ ਪਰਸ ਦੇ ਵਿੱਚ ਕਾਲੀਆਂ ਮਿਰਚਾਂ ਸਾਰਾ ਕੁਛ ਰੱਖਦੇ ਹਨ ਜੇ ਸਾਨੂੰ ਕੋਈ ਪਕੜਦਾ ਹੈ ਤਾਂ ਕੋਈ ਫੜਦਾ ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਉਹਨਾਂ ਦੇ ਉੱਤੇ ਪਾ ਦੇਈਏ ਕਈ ਕੁੜੀਆਂ ਕਰਾਟੇ ਸਿੱਖਦੀਆਂ ਹਨ ਕਿ ਅਸੀਂ ਆਪਣੇ ਹਾ ਲੜਨ ਜੋਗਾ ਸਭ ਕੁਛ ਕਰਦੀਆਂ ਹਨ ਕੁੜੀ ਕਿ ਅਸੀਂ ਅੱਜ ਕੱਲ੍ਹ ਕੁੜੀਆਂ ਸਮਝਦੀਆਂ ਅਸੀਂ ਮੁੰਡਿਆਂ ਤੋਂ ਘੱਟ ਨਹੀਂ ਹੈਗੀਆਂ ਅਸੀਂ ਹਰ ਚੀਜ਼ 'ਚ ਅੱਗੇ ਹਾਂ ਅਤੇ ਦੋਨੋਂ ਇਕੁਅਲ ਨਹੀਂ ਮਤਲਬ ਬਰਾਬਰ ਸਮਝੇ ਜਾਂਦੇ ਹਨ ਅਤੇ ਦੋਨੋ ਇੱਕੋ ਬਰਾਬਰ ਦੇ ਹਨ ਇੱਦਾਂ ਕੁਛ ਨਹੀਂ ਹੈ ਕਿ ਕੁੜੀਆਂ ਘੱਟ ਨੇ ਕੁੜੀਆਂ ਵੀ ਮੁੰਡਿਆਂ ਵਰਗੀਆਂ ਹਨ ਅਤੇ ਇਹ ਅੱਜ ਕੱਲ੍ਹ ਸਮਝਿਆ ਜਾਂਦਾ ਹੈ ਕਿ ਕੁੜੀਆਂ ਬਹੁਤ ਅੱਗੇ ਜਾਣਗੀਆਂ ਅਤੇ ਬਹੁਤ ਅੱਗੇ ਜਾ ਰਹੀਆਂ ਨੇ ਮੁੰਡੇ ਵੀ ਬਹੁਤ ਵਧੀਆ ਕਰਦੇ ਹਨ